ਹੈਲੋ ਹਾਂਜੀ ਭਾਅ ਜੀ ਰਾਮ ਰਾਮ ਜੀ ਆਪਣਾ ਬਜਾਜ ਇਲੈਕਟੀਕਲ ਤੋਂ ਬੋਲ ਰਹੇ ਹੋ ਨਾ ਜੀ ਮੋਡਲ ਟਾਊਨ ਜਲੰਧਰ ਤੋਂ ਹਾਂਜੀ ਭਾਅ ਜੀ ਮੈਂ ਤੁਹਾਡੇ ਤੋਂ ਨਾ ਇੱਥੋਂ ਕੁਛ ਚਾਰ ਦਿਨ ਤੁਹਾਡੇ ਤੋਂ ਫੋਨ ਔਡਰ ਕੀਤਾ ਸੀਗਾ ਹਾਂਜੀ ਹਾਂਜੀ ਭਾਅ ਜੀ ਮੋਹਿਤ ਗੱਲ ਕਰ ਰਿਹਾ ਜੀ ਹਾਂਜੀ ਹਾਂਜੀ ਉਹੀ ਭਾਅ ਜੀ ਆਈਫੋਨ ਚੋਦ੍ਹਾਂ ਪਰੋ ਅਤੇ ਭਾਅ ਜੀ ਉਹ ਮੈਨੂੰ ਥੋ ਸੋਰੀ ਤੁਹਾਨੂੰ ਮੈਂ ਲੇਟ ਰਿਪਲਾਈ ਕਰ ਰਿਹਾ ਮੈਨੂੰ ਦੋ ਦਿਨ ਪਹਿਲਾਂ ਮਿਲ ਗਿਆ ਸੀਗਾ ਅਤੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਸੀਗਾ ਵੀ ਤੁਹਾਡਾ ਫੋਨ ਜਦੋਂ ਮੈਂ ਓਪਨ ਕੀਤਾ ਤਾਂ ਫਸਟਲੀ ਉਹਦੀ ਜਿਹੜੀ ਪੈਕਿੰਗ ਸੀਗੀ ਬਹੁਤ ਵਧੀਆ ਸੀਗੀ ਤੁਸੀਂ ਬੂਬਲ ਰੈਪ 'ਚ ਉਹਨੂੰ ਪ੍ਰੋਪਰ ਪੈਕ ਕਰਕੇ ਭੇਜਿਆ ਅਤੇ ਜਿਹਦੇ ਕਰਕੇ ਉਹਨੂੰ ਕੋਈ ਡੈਮੇਜ ਨਾ ਹੋਵੇ ਅਤੇ ਤੁਹਾਡਾ ਜਿਹੜਾ ਡਿਲਿਵਰੀ ਬੋਆਏ ਸੀਗਾ ਉਹ ਵੀ ਬੰਦਾ ਬਹੁਤ ਵਧੀਆ ਸੀਗਾ ਅਤੇ ਉਹਨੇ ਬਹੁਤ ਅੱਛੀ ਤਰ੍ਹਾਂ ਉਹਨੂੰ ਮਤਲਬ ਲਿਆਂਦਾ ਹੈਂਡਲ ਕੀਤਾ ਫੋਨ ਨੂੰ ਵੀ ਕੋਈ ਫੋਨ ਨੂੰ ਨੁਕਸਾਨ ਨਾ ਪਹੁੰਚੇ ਅਤੇ ਦੂਜੀ ਗੱਲ ਇਹ ਕਿ ਜਿਹੜਾ ਤੁਸੀਂ ਮੈਨੂੰ ਦਿੱਤਾ ਸੀ ਤੁਸੀਂ ਕਿਹਾ ਸੀ ਵੀ ਜਿਹੜਾ ਤੁਹਾਨੂੰ ਨਾਲ ਆਪਾਂ ਕੁਛ ਸਮਾਨ ਭੇਜਾਂਗੇ ਜਿੱਦਾਂ ਤੁਸੀਂ ਮੈਨੂੰ ਕਿਹਾ ਮੈਨੂੰ ਵਾਚ ਗਿਫਟ ਮਿਲੇਗੀ ਅਤੇ ਵੋਚ ਦੇ ਨਾਲ ਤੁਸੀਂ ਜਿਹੜਾ ਮੈਨੂੰ ਕੋਈ ਗਿਫਟ ਭੇਜਿਆ ਸਕ੍ਰੀਨ ਗਾਰਡ ਅਤੇ ਨਾਲ ਇੱਕ ਗਲਾਸ ਗਾਰਡ ਅਤੇ ਨਾਲ ਪਿੱਛੋਂ ਦਾ ਬੈਕ ਕਵਰ ਉਹ ਵੀ ਬਹੁਤ ਸੋਹਣਾ ਅਤੇ ਬਹੁਤ ਵਧੀਆ ਕੁਆਲਿਟੀ ਦਾ ਵੈ ਅਤੇ ਬਾਕੀ ਰਹੀ ਤੁਹਾਡੇ ਫੋਨ ਦੀ ਗੱਲ ਫੋਨ ਤੁਹਾਡਾ ਬਹੁਤ ਵਧੀਆ ਬਿਲਕੁਲ ਸਲਿਮ ਹੈ ਜਿੱਦਾਂ ਤੁਸੀਂ ਕਿਹਾ ਸੀਗਾ ਵੀ ਕੁਆਲਿਟੀ ਵਾਈਜ ਤੁਹਾਨੂੰ ਕੋਈ ਕੰਪਲੇਟ ਨਹੀਂ ਆਏਗੀ ਉਹ ਬਿਲਕੁਲ ਇੱਕ ਸੌ ਇੱਕ ਪ੍ਰਰਸੈਂਟ ਬਿਲਕੁਲ ਵਧੀਆ ਫੋਨ ਹੈਗਾ ਵੈ ਮੈਨੂੰ ਬਹੁਤ ਪਸੰਦ ਆਇਆ ਵੈ ਮੇਰੇ ਦੋਸਤਾਂ ਨੇ ਦੇਖਿਆ ਅਤੇ ਉਹਨੇ ਮੈਨੂੰ ਸਪੈਸ਼ਲ ਪੁੱਛਿਆ ਵੀ ਤੁਸੀਂ ਕਿੱਥੋਂ ਲਿਆ ਅਤੇ ਮੈ ਉਨ੍ਹਾਂ ਨੂੰ ਤੁਹਾਡਾ ਦਿੱਤਾ ਨੰਬਰ ਫੋਨ ਨੰਬਰ ਵੀ ਤੁਹਾਡੀ ਈਮੇਲ ਆਈ ਡੀ ਦੇ ਤੀ ਹੈ ਜੇ ਤੁਹਾਡਾ ਸੋਸ਼ਲ ਮੀਡੀਆ ਤੁਹਾਡਾ ਹੈਂਡਲ ਪੇਜ ਹੈਗਾ ਵਾ ਇੰਸਟਾਗ੍ਰਾਮ ਦਾ ਉਹ ਦੱਸਤਾ ਵੈ ਅਤੇ ਮੈਂ ਅੱਗੇ ਵੀ ਜਿੱਦਾਂ ਨਾ ਇੱਕ ਫੋਨ ਦੋ ਫੋਨ ਹੋਰ ਖਰੀਦਣੇ ਆਪਣੀ ਫੈਮਲੀ ਵਾਸਤੇ ਅਤੇ ਜਦੋਂ ਤੁਹਾਡੇ ਕੋਲ ਇੱਦਾਂ ਦਾ ਕੋਈ ਵਧੀਆ ਕੁਆਲਟੀ ਦਾ ਫੋਨ ਆਵੇ ਤਾਂ ਮੈਨੂੰ ਪਲੀਜ਼ ਤੁਸੀਂ ਮੈਨੂੰ ਕਾਲ ਕਰੀਓ ਅਤੇ ਮੈਂ ਉਹ ਫੋਨ ਤੁਹਾਡੇ ਕੋਲੋਂ ਬਾਏ ਕਰਾਂਗਾ ਅਤੇ ਮੈਨੂੰ ਉਮੀਦ ਹੈ ਕਿ ਜਿਹੜੇ ਅੱਗੇ ਮੈਨੂੰ ਫੋਨ ਮਿਲਣਗੇ ਉਹ ਵੀ ਮੈਨੂੰ ਵਧੀਆ ਹੀ ਮਿਲਣਗੇ ਕਿਉਂਕਿ ਮੈਂ ਇਸ ਫੋਨ ਤੋਂ ਬਹੁਤ ਜ਼ਿਆਦਾ ਖੁਸ਼ ਹਾਂ ਅਤੇ ਮੈਨੂੰ ਬਹੁਤ ਅੱਛਾ ਲੱਗ ਰਿਹਾ ਫੋਨ ਮੇਰੇ ਬੱਚਿਆਂ ਨੂੰ ਵੀ ਮੇਰੀ ਫੈਮਲੀ ਨੂੰ ਵੀ ਇਹ ਫੋਨ ਬਹੁਤ ਜ਼ਿਆਦਾ ਪਸੰਦ ਆਇਆ ਜੀ ਠੀਕ ਹੈ ਭਾਅ ਜੀ ਧੰਨਵਾਦ ਜੀ